ਸਾਡੇ ਕਪੂਰਥਲੇ ਦਾ ਮੌਜੂਦਾ ਐਮ ਐਲ ਏ ਹਨ ਰਾਣਾ ਗੁਰਜੀਤ ਸਿੰਘ ਜੋ ਕਿ ਇੰਡੀਅਨ ਕਾਂਗਰਸ ਪਾਰਟੀ ਤੋਂ ਹਨ ਉਹ ਐਦਕੀ ਸਾਡੇ ਕਪੂਰਥਲੇ ਦੇ ਚੋਣਾਂ ਦੇ ਵਿੱਚੋਂ ਜਿੱਤੇ ਹਨ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਮੈਂ ਉਹਨਾਂ ਦੀ ਕਾਫੀ ਪ੍ਰਸ਼ੰਸਾ ਸੁਣੀ ਹੈ ਉਹਨਾਂ ਨੇ ਸਾਡੇ ਕਪੂਰਥੱਲੇ ਦੇ ਵਿੱਚ ਆ ਕੇ ਬਹੁਤ ਹੀ ਚੰਗੇ ਕੰਮ ਕੀਤੇ ਹਨ ਜੋ ਕਿ ਲੋਕ ਭਲਾਈ ਵਾਸਤੇ ਬਹੁਤ ਹੀ ਵਧੀਆ ਹਨ ਉਹਨਾਂ ਨੇ ਸਾਡੇ ਸ਼ਹਿਰ ਦੀਆਂ ਸੜਕਾਂ ਦੀ ਉਸਾਰੀ ਵਲ ਧਿਆਨ ਦਿੱਤਾ ਸਾਡੇ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਬਹੁਤ ਹੋਰ ਵਧਾਇਆ ਅਤੇ ਸਾਡੇ ਸ਼ਹਿਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਗੰਦਾ ਪਾਣੀ ਆਉਂਦਾ ਸੀ ਉਹਨਾਂ ਨੇ ਉੱਥੇ ਵੀ ਸਾਫ਼ ਪਾਣੀ ਦੀ ਵਿਵਸਥਾ ਕੀਤੀ ਸਾਡੇ ਸ਼ਹਿਰ ਦੇ ਵਿੱਚ ਆ ਕੇ ਉਹਨਾਂ ਨੇ ਹਰਿਆਲੀ ਨੂੰ ਵਧਾਉਣ ਦਾ ਰੁਝਾਨ ਦਿਖਾਇਆ ਉਹਨਾਂ ਨੇ ਬਿਜਲੀ ਦੀ ਸਪਲਾਈ ਅਤੇ ਹੋਰ ਅਜਿਹੇ ਕਈ ਕੰਮ ਕੀਤੇ ਜਿਹੜੇ ਕਿ ਮੱਧ ਵਰਗੀ ਲੋਕਾਂ ਦੇ ਲਈ ਬਹੁਤ ਹੀ ਸਹਾਇਕ ਹਨ ਉਹਨਾਂ ਨੇ ਹਰ ਸਕੂਲਾਂ ਹਸਪਤਾਲਾਂ ਦੇ ਵਿੱਚ ਜਾ ਜਾ ਕੇ ਉੱਥੇ ਦੀ ਸਫਾਈ ਉੱਥੇ ਦੀ ਵਿਵਸਥਾ ਨੂੰ ਦੇਖਿਆ ਜਿਹਦੇ ਵਿੱਚ ਕਿਸੇ ਕਿਸਮ ਦੀ ਸੁਧਾਰ ਦੀ ਲੋੜ ਹੋਵੇ ਉੱਥੇ ਜਾ ਕੇ ਉਹਨਾਂ ਨੇ ਆਪ ਜਾ ਕੇ ਉੱਥੇ ਇਹ ਸਭ ਚੀਜ਼ਾਂ ਦੀ ਜਾਂਚ ਕੀਤੀ ਉਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਅਜਿਹੇ ਉਪਰਾਲੇ ਕੀਤੇ ਜਿਹੜੇ ਕਿ ਲੋਕਾਂ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਏ ਹਨ ਅਸੀਂ ਤਾਂ ਸਾਰੇ ਹੀ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਰਲ ਕੇ ਆਪਣੇ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਅਤੇ ਤਰੱਕੀ ਦਾਰ ਸ਼ਹਿਰ ਬਣਾਈਏ ਧੰਨਵਾਦ